ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਮੈਂ ਨਾ ਬਾਈਸਾਈਕਲ ਦੀ ਥੋੜ੍ਹੀ ਖੋਜ ਜਿਹੀ ਕਰਦੀ ਪਈ ਸੀ ਅਤੇ ਮੈਨੂੰ ਨਾ ਤੁਹਾਡਾ ਨੰਬਰ ਦਿੱਤਾ ਸਾਡੇ ਜਿਹੜੇ ਗੁਆਂਢੀ ਨੇ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਬਾਈਸਾਈਕਲ ਵੇਚਣ ਦਾ ਹੀ ਕੰਮ ਕਰਦੇ ਹੋ ਅਤੇ ਮੈਂ ਕੋਈ ਨਾ ਜਾਣਕਾਰੀ ਲੈਣਾ ਚਾਹੁੰਦੀ ਸੀ ਮਤਲਬ ਤੁਸੀਂ ਕੀ ਤੁਹਾਡਾ ਵਪਾਰ ਕੀ ਹੈਗਾ ਇਹਦੇ ਵਿੱਚ ਬਾਈਸਾਈਕਲ ਵਾਲੀ ਵਿੱਚ ਅੱਛਾ ਜੀ ਆ ਮੇਰੇ ਕੋਲ ਵੀਹ ਤੋਂ ਪੱਚੀ ਹਜ਼ਾਰ ਦਾ ਬਜਟ ਹੈਗਾ ਅਤੇ ਇਹਦੇ ਵਿੱਚ ਤੁਸੀਂ ਜੇ ਮੈਨੂੰ ਕੁਛ ਦੱਸ ਸਕਦੇ ਹੋ ਜੋ ਮੇਰੇ ਕੰਮ ਦਾ ਵੀ ਹੋਵੇ ਅਤੇ ਮੇਰਾ ਮਤਲਬ ਇੰਨੇ ਬਜਟ ਵਿੱਚ ਮੈਨੂੰ ਮਿਲ ਵੀ ਜਾਵੇ ਅਤੇ ਵਧੀਆ ਵੀ ਹੋਵੇ ਟਿਕਾਊ ਵੀ ਹੋਵੇ ਮੈਨੂੰ ਕੋਈ ਦਿੱਕਤ ਨਾ ਆਵੇ ਜਦੋਂ ਮੈਂ ਉਹਨੂੰ ਵਰਤੋਂ ਵਿੱਚ ਲਿਆਵਾ ਤਾਂ ਹਾਂਜੀ ਹਾਂਜੀ ਬਿਲਕੁਲ ਮੈਮ ਹਾਂਜੀ ਮੈਮ ਮੇਰਾ ਨਾ ਛੋਟਾ ਭਰਾ ਹੈਗਾ ਵੀਹ ਸਾਲ ਦੀ ਉਮਰ ਹੈ ਉਹਦੀ ਅਤੇ ਹਾਂਜੀ ਉਹਨੂੰ ਹੁਣ ਜ਼ਰੂਰਤ ਸੀਗੀ ਬਾਈਸਾਈਕਲ ਦੀ ਅਤੇ ਉਹਨੇ ਜਿੱਦਾਂ ਆਉਣਾ ਹੁੰਦਾ ਸਕੂਲ ਜਾਣਾ ਜਾਂ ਟਿਊਸ਼ਨਾਂ 'ਤੇ ਜਾਣਾ ਤਾਂ ਉਹਨੂੰ ਥੋੜ੍ਹੀ ਜਿਹੀ ਦਿੱਕਤ ਆਉਂਦੀ ਹੈ ਅਤੇ ਅਸੀਂ ਸੋਚਿਆ ਕਿ ਕਿਉਂ ਨਾ ਉਹਨੂੰ ਬਾਈਸਾਈਕਲ ਲਿਆ ਦੇਈਏ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਬਿਲਕੁਲ ਨਹੀਂ ਨਹੀਂ ਇਹੋ ਜਿਹੀ ਉਹਦੀ ਕੋਈ ਉੱਚੀ ਨਹੀਂ ਹੈ ਮੈਮ ਅਸੀਂ ਸਿਰਫ਼ ਉਹਦੇ ਸਿਰਫ਼ ਇੱਥੇ ਜਿੱਦਾਂ ਪੜ੍ਹਨ ਜਾਣਾ ਆ ਆਉਣਾ ਜਾਣਾ ਥੋੜ੍ਹੇ ਲੰਬੇ ਪੈਂਡੇ ਉਹਦੇ ਇੰਨੇ ਨਹੀਂ ਹੈਗੇ ਰਸਤੇ ਬਹੁਤ ਥੋੜ੍ਹੇ ਥੋੜ੍ਹੇ ਹੀ ਹੈ ਉਹਨੇ ਕੋਈ ਬਹੁਤ ਲੰਬੇ ਰਸਤਿਆਂ 'ਤੇ ਨਹੀਂ ਜਾਣਾ ਉਹਦੇ ਲੀਏ ਸਾਨੂੰ ਚਾਹੀਦੀ ਹੈ

ਅੱਛਾ ਜੀ ਠੀਕ ਹੈ ਠੀਕ ਹੈ ਅਤੇ ਠੀਕ ਹੈ ਠੀਕ ਹੈ ਮੈਮ ਫਿਰ ਮੈਂ ਇੱਦਾਂ ਕਰਦੀ ਹਾਂ ਤੁਸੀਂ ਰੰਗ ਦੀ ਗੱਲ ਕੀਤੀ ਨਾ ਮੈਨੂੰ ਉਹ ਬਹੁਤ ਵਧੀਆ ਲੱਗੀ ਕਈ ਵਾਰ ਸਾਨੂੰ ਰੰਗ ਜਿਹੜਾ ਚਾਹੀਦਾ ਹੁੰਦਾ ਉਹ ਮਿਲਦਾ ਨਹੀਂ ਹੁੰਦਾ ਪਰ ਮੈਂ ਇਸ ਵਾਰ ਹਾਂਜੀ ਘਰ ਸਲਾਹ ਕਰਕੇ ਨਾ ਆਪਣੇ ਭਰਾ ਨੂੰ ਵੀ ਪੁੱਛ ਕੇ ਕਿ ਕਿਹੜਾ ਰੰਗ ਉਹ ਲੈਣਾ ਚਾਹੁੰਦਾ ਉਸ ਹਿਸਾਬ ਨਾਲ ਆਪਾਂ ਤੁਹਾਡੀ ਦੁਕਾਨ 'ਤੇ ਆਪਾਂ ਤੁਹਾਨੂੰ ਆ ਕੇ ਮਿਲਦੇ ਹਾਂ ਚਲੋ ਠੀਕ ਹੈ ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ